ਤਿੰਨ ਅਪ੍ਰੈਲ ਉੱਨੀ ਸੌ ਪਚਵੰਜਾ ਚੌਦ੍ਹਾਂ ਮਾਰਚ ਉੱਨੀ ਸੌ ਬਿਆਸੀ ਅਠਾਰਾਂ ਮਈ ਉੱਨੀ ਸੌ ਅੱਸੀ ਉੱਨੀ ਜਨਵਰੀ ਉੱਨੀ ਸੌ ਤਰਵੰਜਾ ਚਾਰ ਅਪ੍ਰੈਲ ਉੱਨੀ ਸੌ ਵੀਹ